ਕੁਝ ਸਥਾਨਕ ਰਿਹਾਇਸ਼ ਕਲੱਬ ਇਸ ਤਰ੍ਹਾਂ ਦੇ ਹਨ ਜਿਵੇਂ ਕਿ ਰਿਹਾਇਸ਼ੀ ਜ਼ਮੀਨ ਨੂੰ ਅਸੀਂ ਆਮਦਨੀ ਦੇ ਵਿੱਚ ਪਰਿਵਰਤਨ ਕੀਤਾ ਜਾ ਸਕਦਾ ਹੈ ਜਿਵੇਂ ਦੁਕਾਨਾਂ ਬਣਾ ਕੇ ਉਹ ਉਸਨੂੰ ਕਿਰਾਏ 'ਤੇ ਚਾੜ੍ਹ ਕੇ ਉਸ ਨੂੰ ਮਾਰਕੀਟ ਬਣਾ ਕੇ ਕੀਤਾ ਜਾ ਸਕਦਾ ਹੈ ਅਤੇ ਛੋਟੇ ਘਰਾਂ ਦੇ ਵਿੱਚ ਰੈਂਟ 'ਤੇ ਦੇ ਕੇ ਕਰਾਇਆ ਲਗਭਗ ਉਹਨਾਂ ਦਾ ਹੁੰਦਾ ਹੈ ਤਿੰਨ ਹਜ਼ਾਰ ਚਾਰ ਹਜ਼ਾਰ ਦੇ ਕਰੀਬ ਕਰੀਬ ਕਰਾਇਆ ਹੁੰਦਾ ਹੈ ਇਸ ਤਰ੍ਹਾਂ ਵੀ ਅਸੀਂ ਹਾਊਸਿੰਗ ਵਿਕਲਪ ਮਾਰਕੀਟ ਹਾਊਸਿੰਗ ਰੀਅਲ ਸਟੇਟ ਦੇ ਨਾਲ ਅਸੀਂ ਰੋਜ਼ਾਨਾ ਨੂੰ ਦਰਸਾ ਸਕਦੇ ਹਾਂ ਜਿਵੇਂ ਕਿ ਅਸੀਂ ਵਿਕਲਪ ਹੁੰਦੇ ਨੇ ਜਿਵੇਂ ਦੁਕਾਨਾਂ ਮਾਰਕੀਟਿੰਗ ਅਤੇ ਘਰਾਂ ਦੇ ਵਿੱਚ ਕਮਰੇ ਹੁੰਦੇ ਨੇ ਉਹਨੂੰ ਅਸੀਂ ਕਿਰਾਏ 'ਤੇ ਦੇ ਕੇ ਉਹਨਾਂ ਨੂੰ ਅਸੀਂ ਲੋੜ ਵੱਜੋ ਕਿਸੇ ਵੀ ਤਰੀਕਾ ਦੀ ਕੋਈ ਕੰਮ ਰੋਜ਼ਗਾਰ ਸ਼ੁਰੂ ਕੀਤਾ ਜਾ ਸਕਦਾ ਛੋਟੇ ਛੋਟਾ ਰੋਜ਼ਗਾਰ ਸ਼ੁਰੂ ਕੀਤਾ ਉਸ ਨੂੰ ਵੀ ਅਸੀਂ ਰੀਅਲ ਸਟੇ ਮਾਰਕੀਟਿੰਗ ਹਾਊਸਿੰਗ ਦੇ ਵਿੱਚ ਉਪਲੱਬਧ ਕਰ ਸਕਦੇ ਹਾਂ ਇਸ ਤਰ੍ਹਾਂ ਅਸੀਂ ਹਰ ਕਿਸੇ ਰਿਹਾਇਸ਼ੀ ਛੋਟੇ ਛੋਟੇ ਦੁ ਦੁਕਾਨਾਂ ਨੂੰ ਜਾਂ ਮਕਾਨਾਂ ਨੂੰ ਅਸੀਂ